ਹਾਂਜੀ ਤਕਨੋਲਜੀ ਦੀ ਵਰਤੋਂ ਤਾਂ ਬਹੁਤ ਵਧੀਆ ਹੈ ਸੰਸਾਰ ਵਿੱਚ ਕਿ ਪਹਿਲਾਂ ਦੇ ਨਾ ਪਹਿਲਾਂ ਲੋਕੀਂ ਬਹੁਤ ਦੂਰ ਦੂਰ ਹੁੰਦੇ ਸੀ ਚਿੱਠੀਆਂ ਦੇ ਨਾਲ਼ ਗੱਲ ਕਰਦੇ ਸੀ ਹੁਣ ਤਾਂ ਲੋਕੀਂ ਬਹੁਤ ਨਜ਼ਦੀਕ ਆ ਗਏ ਇਸ ਫ਼ੋਨ ਦੇ ਜ਼ਰੀਏ ਤਕਨੋਲਜੀ ਦੇ ਜ਼ਰੀਏ ਹੁਣ ਸੋਸਲ ਮੀਡੀਆ ਦੀ ਖ਼ਬਰ ਹੁਣ ਇੱਕ ਮਿੰਟ 'ਚ ਸਾਡੇ ਕੋਲ ਆ ਜਾਂਦੀ ਹੈ ਪਹਿਲਾਂ ਤਾਂ ਸਾਨੂੰ ਕੁਝ ਪਤਾ ਨਹੀਂ ਲੱਗਦਾ ਸੀ ਹੁਣ ਬਹੁਤ ਵਧੀਆ ਹੈ ਹੈ ਜਿੱਦਾਂ ਕਿ ਔਰ ਮਤਲਬ ਬਹੁਤ ਇਨਾਂ ਇਹਨਾਂ ਟੈਕਨੋਲਜੀਆਂ ਨੇ ਸਾਡੇ ਬੱਚਿਆਂ ਨੂੰ ਵੀ ਮਤਲਬ ਬਹੁਤ ਅੱਗੇ ਵਧਾਇਆ ਲੇਕਿਨ ਥੋੜ੍ਹਾ ਜਿਹਾ ਇਹਦੇ ਨੁਕਸਾਨ ਵੀ ਐਂ ਜਿੱਦਾਂ ਕਿ ਲੋਕ ਨਾ ਇਹਦਾ ਬਹੁਤ ਮਿਸਯੂਜ਼ ਕਰ ਰਹੇ ਹੈਂ ਅੱਜ ਕੱਲ੍ਹ ਲੋੋਕਾਂ ਦੇ ਅਕਾਊਂਟ ਵਿੱਚ ਪੈਸੇ ਪੁਸੇ ਕੱਢ ਹੋ ਜਾਂਦੇ ਹਾਂ ਇਹ ਥੋੜ੍ਹਾ ਜਿਹਾ ਮਿਸਯੂਜ਼ ਵੀ ਹੈ ਬਟ ਹੈ ਵੈਸੇ ਬਹੁਤ ਵਧੀਆ ਚੀਜ਼ ਹੈ ਸਾਡੇ ਬੱਚਿਆਂ ਵਾਸਤੇ ਬਹੁਤ ਅੱਗੇ ਮਤਲਬ ਅੱਗੇ ਜਾਣ ਨੂੰ ਬਹੁਤ ਵਧੀਆ ਹੈ ਬੱਚਿਆਂ ਲਈ